ਹਾਂਜੀ ਮੈਂ ਦੱਸਣਾ ਚਾਹੁੰਦਾ ਹਾਂ ਮੈਂ ਡਾਂਸ ਮੁਕਾਬਲੇ ਵਿੱਚ ਇੱਕ ਵਾਰ ਭਾਗ ਲਿਆ ਸੀ ਉਦੋਂ ਮੈਂ ਛੋਟਾ ਹੁੰਦਾ ਸੀ ਅਤੇ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਉਸ ਸਮੇਂ ਸਾਡੇ ਸਕੂਲ ਵਿੱਚ ਐਲੂ ਐਨੁਅਲ ਫੰਕਸ਼ਨ ਸੀ ਅਤੇ ਮੈਂ ਉਸ ਵਿੱਚ ਭੰਗੜਾ ਪਾਇਆ ਸੀ ਅਤੇ ਉਹ ਅਨੁਭਵ ਮੇਰੀ ਜ਼ਿੰਦਗੀ ਦਾ ਬਹੁਤ ਵਧੀਆ ਅਨੁਭਵ ਹੈ ਅੱਜ ਮੈਂ ਆਪਣੇ ਮੁੰਡਿਆਂ ਨੂੰ ਵੀ ਇਸ ਬਾਰੇ ਦੱਸਦਾ ਹਾਂ ਕਿ ਵੀ ਪੁੱਤ ਮੈਂ ਬਹੁਤ ਵਧੀਆ ਭੰਗੜਾ ਪਾਇਆ ਸੀ ਅਤੇ ਮੈਨੂੰ ਸਾਰਿਆਂ ਨੇ ਬਹੁਤ ਸਹਰਾਇਆ ਸੀ ਅਤੇ ਪ੍ਰਸ਼ੰਸਾ ਕੀਤੀ ਸੀ ਅਤੇ ਮੈਨੂੰ ਕਈ ਇਨਾਮ ਵੀ ਮਿਲੇ ਸਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਦਸਵੀਂ ਦੀ ਕਲਾਸ ਵਿੱਚ ਭੰਗੜੇ ਦਾ ਸ਼ੌਕੀਨ ਹੁੰਦਾ ਸੀ ਅਸੀਂ ਸਾਰੇ ਮੁੰਡੇ ਇਕੱਠੇ ਹੋ ਕੇ ਭੰਗੜੇ ਪਾਉਂਦੇ ਸੀ ਅਤੇ ਸਾਨੂੰ ਭੰਗੜਾ ਪਾਉਣਾ ਬਹੁਤ ਚੰਗਾ ਲੱਗਦਾ ਸੀ ਇਹ ਗੱਲ ਸਾਡੇ ਅਧਿਆਪਕਾਂ ਨੂੰ ਵੀ ਪਤਾ ਸੀ ਤਾਂ ਕੀ ਹੋਇਆ ਸਾਡੇ ਅਧਿਆਪਕਾਂ ਨੇ ਐਨੂਅਲ ਫੰਕਸ਼ਨ ਉੱਤੇ ਸਾਡਾ ਭੰਗੜਾ ਪਵਾਉਣ ਦਾ ਨਿਰਣਾ ਲਿਆ ਅਤੇ ਸਾਨੂੰ ਮੌਕਾ ਦਿੱਤਾ ਵੀ ਤੁਸੀਂ ਆਪਣੇ ਕਲਾ ਦਾ ਪ੍ਰਦਰਸ਼ਨ ਕਰੋ ਜਦੋਂ ਅਸੀਂ ਭੰਗੜਾ ਪਾਇਆ ਤਾਂ ਸਾਡੇ ਪ੍ਰਿੰਸੀਪਲ ਨੇ ਸਾਨੂੰ ਬਹੁਤ ਹੀ ਸਨਮਾਨਿਤ ਕੀਤਾ ਅਤੇ ਬਹੁਤ ਹੀ ਪਿਆਰ ਦਿੱਤਾ ਸਾਰੇ ਟੀਚਰ ਸਾਨੂੰ ਬਹੁਤ ਹੀ ਪਿਆਰ ਕਰਦੇ ਸਨ ਅਤੇ ਸਾਨੂੰ ਸਾਡੇ ਨਾਲ ਫੋਟੋਆਂ ਵੀ ਖਿਚਵਾਈਆਂ ਸਨ ਅਤੇ ਇਹ ਅਨੁਭਵ ਮੇਰੀ ਜ਼ਿੰਦਗੀ ਦਾ ਇੱਕ ਅਟੁੱਟ ਅਨੁਭਵ ਹੈ ਇਹ ਮੈਂ ਕਹਾਣੀ ਵਾਂਗ ਆਪਣੇ ਮੁੰਡਿਆਂ ਨੂੰ ਸੁਣਾਇਆ ਹੈ ਅਤੇ ਮੇਰੇ ਪੋਤਿਆਂ ਨੂੰ ਵੀ ਮੈਂ ਇਹ ਹੀ ਕਹਾਣੀਆਂ ਜ਼ਰੂਰ ਸੁਣਾਊਂਗਾ ਕਿ ਮੈਂ ਬੇਟਾ ਭੰਗੜਾ ਪਾਉਂਦਾ ਸੀ ਅਤੇ ਮੈਂ ਆਪਣੀ ਜ਼ਿੰਦਗੀ ਦਾ ਉਹ ਅਨੁਭਵ ਤੁਹਾਡੇ ਨਾਲ ਸਾਂਝਾ ਕੀਤਾ ਹੈ ਮੈਨੂੰ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਧੰਨਵਾਦ